ਪੰਜਾਬ ਵਿੱਚ ਜ਼ਿਆਦਾਤਰ ਆਮ ਤੌਰ 'ਤੇ ਦੋ ਮੱਛੀਆਂ ਹੀ ਸਭ ਤੋਂ ਜ਼ਿਆਦਾ ਭ ਮਿਲਦੀਆਂ ਹਨ ਸੰਘਾੜਾ ਅਤੇ ਪਿਆਸੀ ਮੱਛੀ ਇਹ ਦੋਵੇਂ ਮੱਛੀਆਂ ਹੀ ਮੇਰੀ ਮਨ ਪਸੰਦ ਹਨ ਕਿਉਂਕਿ ਇਹ ਇੱਕ ਆਸਾਨੀ ਨਾਲ ਮਿਲ ਜਾਂਦੀਆਂ ਹਨ ਇਹ ਇੱਕ ਰੇਹੜੀ ਤੋਂ ਲੈ ਕੇ ਅਤੇ ਰੈਸਟੋਰੈਂਟ ਤੱਕ ਦਾ ਸਫਰ ਤੈਅ ਕਰਦੀਆਂ ਹਨ ਇਹਨਾਂ ਵਿੱਚੋਂ ਜਿਹੜੀ ਸਭ ਤੋਂ ਵੱਧ ਖਾਈ ਜਾਂਦੀ ਹੈ ਉਹ ਸੰਘਾੜਾ ਮੱਛੀ ਹੀ ਖਾਈ ਜਾਂਦੀ ਹੈ ਉਸਨੂੰ ਕਾਫ਼ੀ ਵੱਖ ਵੱਖ ਤਰੀਕਿਆਂ ਦੇ ਨਾਲ ਬਣਾਇਆ ਜਾਂਦਾ ਹੈ ਰੈਸਟੋਰੈਂਟ ਦੇ ਵਿੱਚ ਤੌ ਵੱਖ ਵੱਖ ਡਿਫਰੈਂਟ ਵੱਖਰੇ ਵੱਖਰੇ ਟੇਸਟ ਦੇ ਤੌਰ 'ਤੇ ਇਹਨੂੰ ਖਾਦਾ ਜਾਂਦਾ ਹੈ ਕੋਈ ਸਟੀਮ ਕਰਕੇ ਖਾਂਦਾ ਹੈ ਕੋਈ ਉਸ ਨੂੰ ਫਰਾਈ ਕਰਕੇ ਜਾਂ ਤਲਕੇ ਖਾਂਦਾ ਹੈ ਪਿਆਸੀ ਮੱਛੀ ਉਸ ਨੂੰ ਕੁਝ ਸਸਤੀ ਹੁੰਦੀ ਹੈ ਜੋ ਬਿਲਕੁਲ ਆਮ ਲੋਕਾਂ ਦੀ ਪਹੁੰਚ ਹੁੰਦੀ ਹੈ ਉਹ ਜ਼ਿਆਦਾ ਇਸ ਕਰਕੇ ਨਹੀਂ ਖਾਈ ਜਾਂਦੀ ਕਿਉਂਕਿ ਉਹਦੇ ਨਾਲ ਪਿਆਸ ਕਾਫ਼ੀ ਲੱਗਦੀ ਹੈ ਉਹ ਛੋਟੇ ਲੋਕਾਂ ਦੀ ਪਹੁੰਚ ਹੋਣ ਦਾ ਕਰਕੇ ਉਸਦੀ ਲਾਗਤ ਕੁਝ ਜ਼ਿਆਦਾ ਲੱਗਦੀ ਹੈ ਸੰਘਾੜਾ ਮੱਛੀ ਥੋੜ੍ਹੀ ਮਹਿੰਗੀ ਹੋਣ ਦਾ ਕਰਕੇ ਉਹ ਚੰਗੇ ਰੈਸਟੋਰੈਂਟਾਂ ਦੇ ਵਿੱਚ ਚੰਗੇ ਲੋਕ ਹੀ ਖਾਂਦੇ ਹਨ ਆਮ ਤੌਰ 'ਤੇ ਪਿਆਸੀ ਮੱਛੀ ਹੀ ਜ਼ਿਆਦਾ ਖਾਦੀ ਜਾਂਦੀ ਹੈ